ਮੈਂ ਪਠਾਨਕੋਟ ਦਾ ਰਹਿਣ ਵਾਲਾ ਅਤੇ ਮੇਰੇ ਮੁਹੱਲੇ ਦੇ ਵਿੱਚ ਇੱਕ ਮੇਰੇ ਕੋਲ ਰੈਲੇਟਿਵ ਦਾ ਮਤਲਬ ਕਿ ਸ਼ਗਨ ਹੈ ਅਤੇ ਮੈਂ ਕ ਕੈਬ ਬੁੱਕ ਕਰਨਾ ਚਾਹੁੰਦਾ ਹਾਂ ਮੈਨੂੰ ਪਤਾ ਚੱਲਿਆ ਹੈ ਕਿ ਤੁਹਾਡੇ ਤੁਸੀਂ ਕੈਬ ਬੁੱਕ ਕਰਦੇ ਹੋ ਅਤੇ ਮੈਨੂੰ ਇਹ ਦੱਸ ਦਿਓ ਕਿ ਮੈਂ ਇਹ ਕੈਬ ਜਿਹੜੀ ਆ ਗੁਰਦਾਸਪੁਰ ਤੱਕ ਬੁੱਕ ਕਰਨੀ ਹੈ ਅਤੇ ਇਹਦਾ ਕਿੰਨੇ ਪੈਸੇ ਲੱਗਣਗੇ ਅਤੇ ਕਿੰਨਾ ਕੁਝ ਜੇ ਕੋਈ ਡਿਸਕਾਊਂਟ ਹੋ ਸਕਦਾ ਤਾਂ ਡਿਸਕਾਊਂਟ ਵੀ ਦੱਸਿਆ ਜਾਵੇ ਅਤੇ ਇਹ ਕੋਈ ਜੂਨ ਮਹੀਨੇ ਕਰਨੀ ਹੈ ਬੁੱਕ ਅਤੇ ਜੂਨ ਮਹੀਨੇ ਦੀ ਕੋਈ ਪੰਜ ਕੁ ਤਰੀਕ ਨੂੰ ਬੁੱਕ ਕਰਨੀ ਹੈ ਅਤੇ ਮੈਨੂੰ ਦੱਸ ਦਿੱਤਾ ਜਾਵੇ ਵੀ ਕਿੰਨੇ ਵਿੱਚ ਹੋਏਗੀ ਅਤੇ ਇਹਦੇ ਜੋ ਬਣਦਾ ਡਿਸਕਾਊਂਟ ਉਹ ਵੀ ਦੱਸ ਦਿੱਤਾ ਜਾਵੇ ਤਾਂ ਜੋ ਅਸੀਂ ਉਹ 'ਤੇ ਵਿਚਾਰ ਕਰ ਸਕੀਏ ਅਤੇ ਮੈਨੂੰ ਦੱਸ ਦਿੱਤਾ ਜਾਵੇ ਮਤਲਬ ਕਿ ਅਤੇ ਦੇਖੋ ਪੰਜ ਸੱਠ